ਆਪਣੀ ਰੋਜ਼ਾਨਾ ਦੀ ਰੂਟੀਨ ਵਿੱਚ ਯੋਗਾ ਨੂੰ ਸ਼ਾਮਿਲ ਕਰਨ ਤੋਂ ਬਾਅਦ ਮੈਂ ਬਹੁਤ ਸਾਰੇ ਲਾਭਾਂ ਦਾ ਅਨੁਭਵ ਕੀਤਾ ਜਿਨ੍ਹਾਂ ਨੇ ਮੇਰੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਸਰੀਰਕ ਤੌਰ 'ਤੇ ਯੋਗਾ ਨੇ ਨਾਟਕੀ ਤੌਰ 'ਤੇ ਮੇਰੀ ਲਚਕਤਾ ਤਾਕਤ ਅਤੇ ਸਮੁੱਚੀ ਸਰੀਰ ਦੀ ਅਨੁਕੂਲਤਾ ਵਿੱਚ ਸੁਧਾਰ ਕੀਤਾ ਮੈਂ ਇਹਨਾਂ ਖੇਤਰਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਵੱਖ ਵੱਖ ਆਸਣਾਂ ਅਤੇ ਖਿੱਚਾਂ ਦੇ ਨਿਯਮਿਤ ਅਭਿਆਸ ਦੇ ਕਾਰਨ ਪਿੱਠ ਅਤੇ ਗਰਦਨ ਦੇ ਪੁਰਾਣੇ ਦਰਦ ਵਿੱਚ ਇੱਕ ਮਹੱਤਵਪੂਰਨ ਕਮੀ ਦੇਖੀ ਜੋ ਪਹਿਲਾਂ ਮੇਰੀ ਰੋਜ਼ਾਨਾ ਦੀਆਂ ਗਤੀਵਿਧੀਆਂ ਨੂੰ ਪ੍ਰਭਾਵਿਤ ਕਰਦੀ ਸੀ ਇਸ ਤੋਂ ਇਲਾਵਾ ਯੋਗਾ ਨੇ ਮੇਰੀ ਮਾਸ਼ਪੇਸ਼ੀ ਟੋਨ ਅਤੇ ਧੀਰਜ ਨੂੰ ਵਧਾਇਆ ਹੈ ਬਿਹਤਰ ਆਸਣਾਂ ਅਤੇ ਸਰੀਰਕ ਜੀਵਨ ਸ਼ਕਤੀ ਵਧੇਰੇ ਭਾਵਨਾ ਵਿੱਚ ਯੋਗਦਾਨ ਪਾਇਆ ਮਾਨਸਿਕ ਮੋਰਚੇ ਅਤੇ ਤਣਾਅ ਅਤੇ ਚਿੰਤਾ ਦਾ ਪ੍ਰਬੰਧਨ ਕਰਨ ਲਈ ਯੋਗਾ ਇੱਕ ਮਹੱਤਵਪੂਰਨ ਰਿਹਾ ਯੋਗਾ ਦੁਆਰਾ ਸਿੱਖਿਆ ਗਿਆ ਦਿਮਾਗੀ ਅਤੇ ਸਾਹ ਨਿਯੰਤਰਣ ਕਰਨ ਵਾਲੀਆਂ ਤਕਨੀ ਤਕਨੀਕਾਂ ਨੇ ਮੈਨੂੰ ਕੇਂਦਰਿਤ ਅਤੇ ਸ਼ਾਂਤ ਰਹਿਣ ਲਈ ਪ੍ਰਭਾਵਸ਼ਾਲੀ ਸਾਧਨ ਪ੍ਰਦਾਨ ਕੀਤੇ ਨੇ ਇੱਥੋਂ ਤੱਕ ਕਿ ਮੰਗ ਵਾਲੀਆਂ ਸਥਿਤੀਆਂ ਦੇ ਬਾਵਜੂਦ ਇਸ ਨਾਲ ਕੰਮ 'ਤੇ ਇਕਾਗਰਤਾ ਅਤੇ ਉਤਪਾਦਕਤਾ ਵਿੱਚ ਸੁਧਾਰ ਹੋਇਆ ਹੈ ਨਾਲ ਹੀ ਇੱਕ ਹੋਰ ਸੰਤੁਲਿਤ ਭਾਵਨਾਤਮਕ ਸਥਿਤੀ ਹੈ ਯੋਗਾ ਦੇ ਧਿਆਨ ਦੇ ਅਭਿਆਸਾਂ ਨੇ ਬਿਹਤਰ ਨੀਂਦ ਦੀ ਗੁਣਵੱਤਾ ਅਤੇ ਜੀਵਨ ਬਾਰੇ ਵਧੇਰੇ ਸਕਾਰਾਤਮਕ ਦ੍ਰਿਸ਼ਟੀਕੋਣ ਵਿੱਚ ਵੀ ਯੋਗਦਾਨ ਪਾਇਆ ਸਵੈ ਜਾਗਰੂਕਤਾ ਅਤੇ ਆਤਮ ਨਿਰੀਖਣ 'ਤੇ ਜ਼ੋਰ ਨੇ ਆਪਣੇ ਬਾਰੇ ਮੇਰੀ ਸਮਝ ਨੂੰ ਡੂੰਘਾ ਕੀਤਾ ਹੈ ਜਿਸ ਨਾਲ ਜ਼ਿੰਦਗੀ ਦੀਆਂ ਚੁਣੌਤੀਆਂ ਨੂੰ ਵਧੇਰੇ ਲਚਕੀਲੇਪਣ ਅਤੇ ਸਮਾਨਤਾ ਨਾਲ ਨੈਵੀਗੇਟ ਕਰਨ ਵਿੱਚ ਮੇਰੀ ਮਦਦ ਕੀਤੀ ਗਈ ਆ ਕੁੱਲ ਮਿਲਾ ਕੇ ਯੋਗਾ ਨੇ ਮੇਰੇ ਮਨ ਸਰੀਰ ਅਤੇ ਆਤਮਾ ਦੇ ਵਿਚਕਾਰ ਇੱਕ ਸਦਭਾਵਨਾ ਪੂਰਨ ਸੰਬੰਧ ਨੂੰ ਉਤਸ਼ਾਹਿਤ ਕੀਤਾ ਹੈ ਜਿਸ ਨਾਲ ਮੇਰੇ ਜੀਵ ਨੂੰ ਅੰਦਰੂਨੀ ਸ਼ਾਂਤੀ ਬਿਹਤਰ ਸਿਹਤ ਅਤੇ ਵਧੇਰੇ ਆਧਾਰਿਤ ਮੌਜੂਦਗੀ ਦੀ ਭਾਵਨਾ ਭਰਪੂਰ ਬਣਾਇਆ ਯੋਗ ਹਰ ਇੱਕ ਬੰਦੇ ਨੂੰ ਰੋਜ਼ ਰੂਟੀਨ ਵਿੱਚ ਲਗਾਤਾਰ ਕਰਦੇ ਰਹਿਣਾ ਚਾਹੀਦਾ ਜਿਸ ਨਾਲ ਸਿਹਤ ਦੀ ਤੰਦਰੁਸਤੀ ਬਣਦੀ ਹੈ ਸਰੀਰ ਨਿਰੋਗ ਰਹਿੰਦਾ ਹੈ